ਸਤਿ ਸ਼੍ਰੀ ਅਕਾਲ ਜੀ ਮੈਂ ਆਪਣੇ ਪੁਰਾਣੇ ਫੋਨ ਨੂੰ ਅਪਗ੍ਰੇਡ ਕਰਨ ਦੀ ਸਲਾਹ ਬਣਾਈ ਹੈ ਅਤੇ ਮੈਂ ਸੋਚ ਰਿਹਾ ਹਾਂ ਕਿ ਮੈਂ ਸੈਮਸੰਗ ਐੱਸ ਟਵੈਂਟੀ ਫਾਈਵ ਅਲਟਰਾ ਲਵਾਂ ਕੀ ਤੁਸੀਂ ਮੈਨੂੰ ਇਸ ਫੋਨ ਬਾਰੇ ਕੋਈ ਜਾਣਕਾਰੀ ਮੁਹੱਈਆ ਕਰਵਾ ਸਕਦੇ ਹੋ ਇਸ ਮਾਡਲ ਦੇ ਬਾਰੇ ਅਤੇ ਇਸ ਦੀ ਕੀ ਕੀਮਤ ਹੋਵੇਗੀ ਤਾਂ ਜੋ ਮੈਂ ਆਪਣੇ ਬਜਟ ਦੇ ਹਿਸਾਬ ਨਾਲ ਇਹਨੂੰ ਲੈਣ ਲਈ ਅੱਗੇ ਪ੍ਰਕਿਰਿਆ ਸੋਚ ਸਕਾਂ ਅਤੇ ਨਾਲ ਹੀ ਕੀ ਤੁਸੀਂ ਮੈਨੂੰ ਇਹ ਦੱਸ ਸਕਦੇ ਹੋ ਕਿ ਇਸ ਫੋਨ 'ਤੇ ਕੀ ਆਫਰ ਚੱਲ ਰਹੇ ਹਨ ਸਾਡੇ ਕੋਲ ਤਾਂ ਜੋ ਮੈਂ ਜਲਦੀ ਤੋਂ ਜਲਦੀ ਇਹਨੂੰ ਆਪਣੇ ਮਨ ਪਸੰਦੀਦਾ ਅਤੇ ਵਧੀਆ ਔਫਰ ਨਾਲ ਲੈ ਕੇ ਇਹਨੂੰ ਆਪਣਾ ਨਵਾਂ ਫੋਨ ਬਣਾਵਾਂ ਧੰਨਵਾਦ